ਅੱਜ ਦੇ ਸਮੇਂ ਵਿੱਚ ਪੁਲੀਸ ਜਿਹੜੀ ਹੈ ਉਹ ਦੁਰਘਟਨਾਵਾਂ ਨੂੰ ਬਹੁਤ ਚੰਗੇ ਤਰੀਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੇ ਖੇਤਰ ਵਿੱਚ ਵੀ ਜੋ ਵੀ ਅਪਰਾਧ ਹੁੰਦੇ ਨੇ ਪੁਲਿਸ ਜਿਹੜੀ ਹੈ ਉਹ ਸਰਕਾਰ ਵੱਲੋਂ ਬਹੁਤ ਉਹਨਾਂ ਨੂੰ ਚੰਗੀ ਤਰ੍ਹਾਂ ਚੇਤੰਨ ਕੀਤਾ ਗਿਆ ਹੈ ਜਗ੍ਹਾ ਜਗ੍ਹਾ 'ਤੇ ਪੁਲਿਸ ਨੇ ਚੌਂਕੀਆਂ ਬਣਵਾਈਆਂ ਬਣਵਾ ਦਿੱਤੀਆਂ ਗਈਆਂ ਨੇ ਹਰ ਚੌਂਕ ਦੇ ਵਿੱਚ ਤੁਹਾਨੂੰ ਪੁਲਿਸ ਦੀ ਇੱਕ ਗੱਡੀ ਖੜੀ ਨਜ਼ਰ ਆਵੇਗੀ ਪੁਲਿਸ ਜਿਹੜੀ ਹੈ ਤੁਹਾਨੂੰ ਹਰ ਇਲਾਕੇ ਥੋੜ੍ਹੀ ਥੋੜ੍ਹੀ ਦੂਰੀ 'ਤੇ ਤੁਹਾਨੂੰ ਪੁਲਿਸ ਜਿਹੜੀ ਹੈ ਉਹ ਨਜ਼ਰ ਆ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਇਲਾਕੇ ਭੀੜੇ ਇਲਾਕੇ ਨੇ ਜਿਵੇਂ ਗਲੀਆਂ ਆਦਿ ਦੇ ਜਿੱਥੇ ਪੁਲਿਸ ਦੀ ਗੱਡੀ ਨਹੀਂ ਜਾ ਸਕਦੀ ਉੱਥੇ ਪੁਲਿਸ ਨੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੁਲਿਸ ਕਰਮਚਾਰੀਆਂ ਨੂੰ ਮੋਟਰਸਾਈਕਲ ਪ੍ਰੋਵਾਈਡ ਕੀਤੇ ਨੇ ਉਹ ਮੋਟਰਸਾਈਕਲ 'ਤੇ ਗਸ਼ਤ ਕਰਦੇ ਨੇ ਉੱਥੇ ਜਾ ਕੇ ਤਾਂ ਕੇ ਕੋਈ ਵੀ ਇਲਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਹੈ ਅਪਰਾਧ ਨਾ ਹੋ ਸਕੇ ਕੋਈ ਦੁਰਘਟਨਾ ਨਾ ਵਾਪਰ ਸਕੇ ਅਤੇ ਪੁਲਿਸ ਵੱਲੋਂ ਤਾਂ ਮੇਰੇ ਹਿਸਾਬ ਨਾਲ ਅੱਜ ਦੇ ਜ਼ਮਾਨੇ ਦੇ ਵਿੱਚ ਕਾਫ਼ੀ ਜ਼ਿਆਦਾ ਮਤਲਬ ਪੁਲਿਸ ਆਪਣਾ ਜਿਹੜਾ ਰੋਲ ਹੈ ਚੰਗੀ ਤਰ੍ਹਾਂ ਨਿਭਾ ਰਹੀ ਹੈ ਜੇ ਨਾਗਰਿਕਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਪੁਲਿਸ ਤਾਂ ਚਲੋ ਆਪਣਾ ਕੰਮ ਕਰ ਰਹੀ ਦੀ ਹੈ ਪੰਜੇ ਉਂਗਲਾਂ ਕਿਤੇ ਵੀ ਬਰਾਬਰ ਨਹੀਂ ਹੁੰਦੀਆਂ ਪੁਲਿਸ ਚੇ ਦੀ ਬਦਨਾਮੀ ਹੁੰਦੀ ਕਿ ਪੁਲਿਸ ਜਿਹੜੀ ਹੈ ਇਹ ਕਰਪਟ ਹੈ ਇਹ ਪੈਸੇ ਲੈ ਕੇ ਛੱਡ ਦਿੰਦੀ ਹੈ ਅਤੇ ਮਤਲਬ ਬਹੁਤ ਸਾਰੇ ਚੰਗੇ ਪੁਲਿਸ ਕਰਮਚਾਰੀ ਵੀ ਹੈਗੇ ਨੇ ਜਿਹੜੇ ਕਿ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਧਿਆਨ ਰੱਖਦੇ ਨੇ ਅਤੇ ਲੋਕਾਂ ਨੂੰ ਆਪਣੇ ਆਪ ਵੀ ਆਪਣੀ ਸੁਰੱਖਿਆ ਦੇ ਲਈ ਜਿਹੜਾ ਹੈ ਜਾਗਰੂਕ ਹੋਣ ਦੀ ਲੋੜ ਹੈ ਲੋਕਾਂ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਜਦੋਂ ਇੰਨੀ ਲੁੱਟ ਖੋ ਪਈ ਹੋਈ ਹੈ ਤਾਂ ਬਹੁਤੇ ਕੋਈ ਅੱਜ ਜਿਵੇਂ ਸੋਨਾ ਵੀ ਬਹੁਤਾ ਪਾ ਕੇ ਬਾਹਰ ਨਹੀਂ ਨਿਕਲਣਾ ਚਾਹੀਦਾ ਫੋਨ ਆਦਿ ਦੀ ਆਪਣੇ ਆਪ ਦੀ ਸੰਭਾਲ ਕਰੀਏ ਹੁਣ ਸੜਕ 'ਤੇ ਤੁਰੇ ਜਾਂਦੇ ਅਸੀਂ ਆਪਣਾ ਫੋਨ ਚਲਾ ਆਪਣੇ ਕੰਨ ਨਾਲ ਲਾਇਆ ਹੋਵੇ ਸਾਡਾ ਗੱਲ ਵੱਲ ਧਿਆਨ ਹੋਵੇ ਤਾਂ ਕੋਈ ਵੀ ਸਾਡਾ ਫੋਨ ਖੋ ਕੇ ਲੈ ਜਾਵੇ ਤਾਂ ਹੁਣ ਉੱਥੇ ਕੀ ਕਰੋਗੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਹਰ ਤਰੀਕੇ ਦੇ ਨਾਲ ਆਪਣੇ ਪਰਸ ਆਦਿ ਸੰਭਾਲ ਕੇ ਤੁਰੀਏ ਤਾਂ ਕਿ ਨਾ ਕੋਈ ਇਸ ਤਰ੍ਹਾਂ ਦੇਖੇ ਅਤੇ ਨਾ ਹੀ ਲੋਕੀ ਜਿਹੜੇ ਨੇ ਇਸ ਪਾਸੇ ਤੁਰਨ ਅਤੇ ਇਹ ਸਾਰੀ ਜਿੰਮੇਵਾਰੀ ਪੁਲਿਸ ਦੀ ਉਹਨਾਂ ਲੋਕਾਂ ਨੂੰ ਵੀ ਆਪਣੇ ਆਪ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ